ਪੰਜਾਬ ਵਿੱਚ ਮਨੋਰੰਜਨ ਦ੍ਰਿਸ਼ ਭਾਰਤ ਦੇ ਦੂਜੇ ਰਾਜਾਂ ਨਾਲ ਇਹ ਤੁਲਨਾ ਕਰਦਾ ਹੈ ਕਿਉਂ ਕਿਉਂਕਿ ਪੰਜਾਬ ਵਿੱਚ ਹਰ ਹਰ ਤਿਉਹਾਰ 'ਤੇ ਮੇਲੇ ਲੱਗਦੇ ਹਨ ਜਗ੍ਹਾ ਜਗ੍ਹਾ ਮੇਲੇ ਲਗਾਏ ਜਾਂਦੇ ਹਨ ਜਿਹੜੇ ਕਿ ਉਹਨਾਂ ਦੀ ਸ਼ਾਨ ਵਧਾਉਂਦੇ ਹਨ